ਜਿਵੇਂ ਕਿ ਸਾਡੇ ਪੰਜਾਬ ਵਿੱਚ ਬਹੁਤ ਹੀ ਸਾਰੀਆਂ ਸਕੀਮਾਂ ਹਨ ਜੋ ਕਿ ਸਾਡੀ ਪੰਜਾਬ ਸਰਕਾਰ ਨੇ ਲਾਗੂ ਕੀਤੀਆਂ ਹੋਈਆ ਹਨ ਪਰ ਉਨ੍ਹਾਂ ਸਾਰੀ ਸਕੀਮਾਂ ਦਾ ਸਾਨੂੰ ਕਿਸੇ ਨੂੰ ਵੀ ਕੋਈ ਫਾਇਦਾ ਨਹੀਂ ਹੁੰਦਾ ਹੈ ਕਿਉਂਕਿ ਜਦੋਂ ਵੀ ਨਵੀਂ ਸਰਕਾਰ ਆਉਂਦੀ ਹੈ ਉਹ ਪੁਰਾਣੀ ਸਕੀਮਾਂ ਨੂੰ ਬੰਦ ਕਰ ਦਿੰਦੀ ਹੈ ਜਦੋਂ ਲੋਕ ਉਹਦੀ ਸੁਵਿਧਾ ਲੈਣ ਲਈ ਅੱਗੇ ਆਉਂਦੇ ਹਨ ਤਦ ਤੱਕ ਉਹ ਸਾਰੀ ਸੁਵਿਧਾਵਾਂ ਜਿਹੜੀਆਂ ਹਨ ਉਹ ਸਕੀਮਾਂ ਜਿਹੜੀਆਂ ਹਨ ਉਹ ਬੰਦ ਹੋ ਜਾਂਦੀਆਂ ਹਨ ਅਤੇ ਇਸ ਕਰਕੇ ਕੋਈ ਵੀ ਇਨ੍ਹਾਂ ਸਕੀਮਾਂ ਦਾ ਕੋਈ ਵੀ ਚੰਗੀ ਤਰ੍ਹਾਂ ਲਾਭ ਨਹੀਂ ਲੈ ਪਾਉਂਦਾ ਹੈ ਅਤੇ ਜਿਹੜੀਆਂ ਸਕੀਮਾਂ ਪੰਜਾਬ ਦੇ ਵਿੱਚ ਸਾਡੀ ਸਰਕਾਰ ਲਾਗੂ ਕਰਦੀ ਹੈ ਉਹ ਸਿਰਫ਼ ਕੁਝ ਟਾਈਮ ਲਈ ਲਾਗੂ ਕਰਦੀ ਹੈ ਕਿਉਂਕਿ ਉਹ ਸਿਰਫ਼ ਜਦੋਂ ਉਹਨਾਂ ਨੇ ਆਪਣੀ ਨਵੀਂ ਸਰਕਾਰ ਬਣਦੀ ਹੈ ਸਿਰਫ਼ ਉਦੋਂ ਉਹ ਲੋਕਾਂ ਨੂੰ ਖੁਸ਼ ਕਰਨ ਵਾਸਤੇ ਸਕੀਮਾਂ ਸ਼ੁਰੂ ਕਰ ਦਿੰਦੀ ਹੈ ਪਰ ਕੁਛ ਸਮੇਂ ਬਾਅਦ ਉਹ ਸਕੀਮਾਂ ਨੂੰ ਬੰਦ ਕਰ ਦਿੰਦੀ ਹੈ ਜਿਵੇਂ ਕਿ ਕੁਛ ਪਹਿਲਾਂ ਕੁਛ ਟਾਈਮ ਪਹਿਲਾਂ ਸਾਡੀ ਪੰਜਾਬ ਸਰਕਾਰ ਨੇ ਇਹ ਸਕੀਮ ਸ਼ੁਰੂ ਕੀਤੀ ਸੀ ਕਿ ਲੋਕਾਂ ਨੂੰ ਚਾਰ ਰੁਪਏ ਕਿਲੋ ਆਟਾ ਅਤੇ ਵੀਹ ਰੁਪਏ ਕਿਲੋ ਦਾਲਾਂ ਮਿਲਣਗੀਆਂ ਪਰ ਉਹ ਸਕੀਮ ਥੋੜ੍ਹਾ ਟਾਈਮ ਚੱਲੀ ਹੈ ਉਸ ਤੋਂ ਬਾਅਦ ਉਹ ਬੰਦ ਹੋ ਗਈ ਹੈ ਅਤੇ ਉਸ ਤੋਂ ਬਾਅਦ ਜਿਹੜੇ ਲੋਕ ਗਰੀਬ ਹਨ ਉਹ ਅਜੇ ਵੀ ਉਹ ਸਕੀਮ ਲਈ ਜੇ ਜਾਂਦੇ ਹਨ ਉੱਥੇ ਕਿ ਹਾਂਜੀ ਕਿ ਸਾਨੂੰ ਇਹ ਚੀਜ਼ ਦੇ ਦਿਉ ਤਾਂ ਉਹਨਾਂ ਨੂੰ ਉਹ ਮਨਾ ਕਰ ਦਿੰਦੇ ਹੈ ਕਿ ਹਾਂਜੀ ਥੋੜ੍ਹੇ ਟਾਈਮ ਤੱਕ ਆ ਜਾਵੇਗੀ ਪਰ ਉਹਨਾਂ ਨੂੰ ਮਿਲਦੀ ਨਹੀਂ ਹੈ